ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀ ਹੈ ਅਤੇ ਮੈਂ ਗੁਰਦਾਸਪੁਰ ਤੋਂ ਬੋਲਦੀ ਪਈ ਹਾਂ ਸ਼ੰਕਰ ਨਗਰ ਤੋਂ ਹਾਂਜੀ ਅੱਜ ਮੈਂ ਤੁਹਾਨੂੰ ਜਿਵੇਂ ਪੰਜਾਬੀ ਦੇ ਬਾਰੇ ਵਿੱਚ ਦੱਸਣਾ ਚਾਹੁੰਦੀ ਹਾਂ ਸਾਡਾ ਜਿਹੜਾ ਪੰਜਾਬ ਹੈਗਾ ਆ ਮਤਲਬ ਗੁਰੂਆਂ ਦੀ ਧਰਤੀ ਹੈਗੀ ਹੈ ਕਿਉਂਕਿ ਇਹਦੇ ਵਿੱਚ ਸਾਡੇ ਜਿਹੜੇ ਦਸ ਦਸ ਗੁਰੂ ਆਉਂਦੇ ਹਨ ਅਤੇ ਜਿਹੜੀ ਮਤਲਬ ਸਾਡੇ ਪੰਜਾਬ ਵਿੱਚ ਜਿਹੜੀ ਪੰਜਾਬੀ ਹੈ ਪੰਜਾਬੀ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਕਿਉਂਕਿ ਪੰਜਾਬੀ ਵਿੱਚ ਸਾਡੇ ਪੰਜਾਬ ਦੇ ਜਿੰਨੇ ਵੀ ਕੰਮ ਹੈਗੇ ਹੈ ਜਿੰਨੇ ਵੀ ਮਤਲਬ ਦਫਤਰਾਂ 'ਚ ਕੰਮ ਹੈਗੇ ਹੈ ਉਹ ਪੰਜਾਬੀ ਵਿੱਚ ਅਜੇ ਤੱਕ ਵੀ ਪੰਜਾਬੀ ਵਿੱਚ ਹੀ ਚੱਲਦੇ ਹਨ ਕੋਈ ਅਸੀਂ ਫਾਰਮ ਵੀ ਫਿਲ ਕਰਨਾ ਉੱਥੇ ਵੀ ਉਹ ਮਤਲਬ ਪੰਜਾਬੀ ਪੰਜਾਬੀ ਹੀ ਚੱਲਦੀ ਹੈ ਕਿਉਂਕਿ ਇਹਦੇ ਵਿੱਚ ਬੱਚਿਆਂ ਨੂੰ ਅੱਜ ਕੱਲ੍ਹ ਜਿਹੜੇ ਟੈਸਟ ਮਿਲਦੇ ਹੈ ਉਹ 'ਚ ਵੀ ਜਿਹੜੇ ਪੰਜਾਬੀ ਵਿੱਚ ਵੀ ਆਉਂਦੇ ਹਨ ਜਿਸਨੂੰ ਪੀਟੈਟ ਹੋ ਗਿਆ ਸਾਨੂੰ ਜਦੋਂ ਅਸੀਂ ਬੀ ਐਡ ਦਾ ਵੀ ਟੈਸਟ ਦਿੰਦੇ ਹੈਗੇ ਹਾਂ ਪੀਟੈਟ ਉਹ ਵੀ ਪੰਜਾਬੀ ਵਿੱਚ ਹੀ ਆਉਂਦਾ ਹੈਗਾ ਉਹਦੇ ਵਿੱਚ ਜਿਹੜੇ ਹੈਗੇ ਇੱਕ ਤਾਂ ਇੰਗਲਿਸ਼ 'ਚ ਆਉਂਦਾ ਮੀਡੀਅਮ ਇੱਕ ਆਉਂਦਾ ਪੰਜਾਬੀ ਵਿੱਚ ਅਤੇ ਪੰਜਾਬੀ ਜਿਹੜੀ ਹੈ ਸਭ ਤੋਂ ਪਹਿਲਾਂ ਪੋਟ ਸਾਡੀ ਜਿਹੜੀ ਹੈ ਪ੍ਰੈਫਰ ਜਿਹੜਾ ਹੁੰਦਾ ਪੰਜਾਬੀ ਪੰਜਾਬ ਵਿੱਚ ਪੰਜਾਬ ਵਿੱਚ ਜਿਹੜੇ ਬੱਚੇ ਹੈਗੇ ਹੈ ਉਹਨਾਂ ਨੂੰ ਪੰਜਾਬੀ ਆਉਣੀ ਬਹੁਤ ਜ਼ਰੂਰੀ ਕੰਪਲਸਰੀ ਆ ਕਿਉਂਕਿ ਇਹ ਸਬਜੈਕਟ ਜਿਹੜਾ ਪੰਜਾਬੀ ਦਾ ਹੁੰਦਾ ਸਾਡੇ ਮਤਲਬ ਸਾਰੇ ਮਤਲਬ ਪੰਜਾਬੀ ਦਾ ਸਬਜੈਕਟ ਜਿਹੜਾ ਸਾਡਾ ਮਤਲਬ ਪਲਸ ਟੂ ਪਲਸ ਟੂ ਮਤਲਬ ਕਿ ਅੱਗੇ ਜਿਹੜਾ ਅਸੀਂ ਬੀ ਏ ਕਰਦੇ ਹਾਂ ਉਹਦੇ ਨਾਲ ਵੀ ਚੱਲਦਾ ਹੈਗਾ ਕਿਉਂਕਿ ਪੰਜਾਬੀ ਜਿਹੜੀ ਸਾਡੀ ਹੈਗੀ ਆ ਪੰਜਾਬ ਦੀ ਸਾਡੀ ਦੇਵਨਾਗਰੀ ਜਿਹੜੀ ਹੈਗੀ ਸਾਡੀ ਗੁਰਮੁਖੀ ਭਾਸ਼ਾ ਜਿਹੜੀ ਹੈਗੀ ਹੈ ਗੁਰਮੁਖੀ ਹੈ ਜਿਹੜੀ ਭਾਸ਼ਾ ਮੰਨੀ ਜਾਂਦੀ ਹਨ ਪੰਜਾਬੀ ਨੂੰ ਜਿਹੜਾ ਸਾਡੇ ਪੰਜਾਬ ਵਿੱਚ ਬੜਾ ਹੀ ਮਹੱਤਵ ਦਿੱਤਾ ਜਾਂਦਾ ਹੈ ਕਿਉਂਕਿ ਇਹ ਗੁਰੂਆਂ ਦੀ ਧਰਤੀ ਹੈ ਅਤੇ ਪੰਜਾਬ ਵਿੱਚ ਪੰਜਾਬੀ ਨੂੰ ਜਿਹੜਾ ਪੂਰਾ ਮਹੱਤਵ ਦਿੱਤਾ ਜਾਂਦਾ ਹੈਗਾ ਆ ਪੰਜਾਬੀ ਸਾਡੀ ਮਾਂ ਬੋਲੀ ਹੈਗੀ ਆ ਸਾਡੀ ਉਪਭਾਸ਼ਾ ਹੈਗੀ ਹੈ ਹੁੰਦੀ ਪੰਜਾਬੀ ਨੂੰ ਸਾਡਾ ਪੰਜਾਬ ਵਿੱਚ ਸਾਡੀ ਮਾਂ ਬੋਲੀ ਮੰਨਿਆ ਜਾਂਦਾ ਹੈ ਧੰਨਵਾਦ